ਸਾਡੇ ਖੇਤਰ ਦੇ ਵਿੱਚ ਜਣੇਪਾ ਦੀ ਦੇਖਭਾਲ ਬਹੁਤ ਹੀ ਚੰਗੀ ਹੁੰਦੀ ਹਨ ਕਿਉਂਕਿ ਸਾਡੇ ਪਿੰਡ ਵਿੱਚ ਆਸ਼ਾ ਵਰਕਰ ਨੂੰ ਲੈ ਕੇ ਜਾਂਦੇ ਹਨ ਜੋ ਕਿ ਸਾਡੀ ਬਹੁਤ ਦੇਖਭਾਲ ਕਰਦੇ ਹਨ ਉਹ ਉੱਥੇ ਹਸਪਤਾਲ ਵਿੱਚ ਲਿਜਾ ਕੇ ਸਾਨੂੰ ਬਹੁਤ ਹੀ ਚੰਗੀ ਤਰ੍ਹਾਂ ਸਾਡੀ ਦੇਖਭਾਲ ਕਰਦੇ ਹਨ ਉਹ ਸਾਡੀ ਨੋਰਮਲ ਡਿਲੀਵਰੀ ਕਰਨ ਦੀ ਹੀ ਕੋਸ਼ਿਸ਼ ਕਰਦੇ ਹਨ ਪਰ ਜੇ ਸੀਰੀਅਸ ਹੋਵੇ ਤਾਂ ਹੀ ਵੱਡਾ ਆਪਰੇਸ਼ਨ ਕਰਦੇ ਹਨ ਹਸਪਤਾਲ ਵਿੱਚ ਬੱਚਿਆਂ ਲਈ ਵੀ ਬਹੁਤ ਸਹੂਲਤਾਂ ਹਨ ਉਹਨਾਂ ਦੇ ਲਈ ਉੱਥੇ ਵਧੀਆ ਮਸ਼ੀਨਾਂ ਦਾ ਪ੍ਰਬੰਧ ਹੈ ਜੋ ਕਿ ਜੇ ਉਹ ਬੱਚੇ ਬਿਮਾਰ ਹੁੰਦੇ ਹਨ ਉਹਨਾਂ ਨੂੰ ਕਿਤੇ ਦੂਜੀ ਜਗ੍ਹਾ 'ਤੇ ਨਹੀਂ ਜਾਣਾ ਪੈਂਦਾ ਉੱਥੇ ਹੀ ਮਸ਼ੀਨਾਂ ਵਿੱਚ ਪਾ ਦਿੱਤਾ ਜਾਂਦਾ ਹੈ ਅਤੇ ਫਿਰ ਉਹਨਾਂ ਦਾ ਬਹੁਤ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਹੈ ਬੱਚਿਆਂ ਲਈ ਉੱਥੇ ਬਹੁਤ ਹੀ ਵਧੀਆ ਪ੍ਰਬੰਧ ਹੁੰਦਾ ਹੈ ਅਤੇ ਸਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਪੈਂਦੀ ਸਾਡੇ ਪਿੰਡ ਵਿੱਚ ਸਾਡੇ ਹਸਪਤਾਲ ਵਿੱਚ ਬਹੁਤ ਚੰਗੀ ਦੇਖਭਾਲ ਕੀਤੀ ਜਾਂਦੀ ਹੈ ਥੈਂਕ ਯੂ